ਗੈਸ ਬਾ ਮੈ ਮੈਨੇ ਸੋਟਾ ਬਿਹਾਰ ਓਹਾਏ ਓ ਲੁਧਿਆਣਾ ਬੀਜਿੰਗ ਟੋਕਿਓ ਸਿੰਜੂਵੂ ਔਕਲੈਂਡ ਜੋਹੈਸਵਰਗ ਵਾਨ ਮਾਸਕੋ ਤਾਲੀਵ ਜੈ ਗਾਂਧੀਨਗਰ ਡੈਲੀ ਲਖਨਊ ਇਸਲਾਮਾਬਾਦ ਲਾਹੌਰ ਰੀਓ ਦੀ ਜਨਰੀਓ ਸਿਓਲ ਟਿਓਂਗਨ ਓਟਾਵਾ ਟੋਰੋਂਟੋ ਕੈਲੀਫੋਰਨੀਆ ਨਿਊਯੋਕ ਣੀਜਰਸੀ ਕੋਸਟਾਲੀਕਾ ਪੋਰਤਲੀਕੋ